ਭੰਗੜੇ ਵਿੱਚ ਕਈ ਡਾਂਸਰ ਜ਼ੋਰਦਾਰ ਲੱਤਾਂ ਮਾਰਦੇ ਹਨ ਛਾਲਾਂ ਮਾਰਦੇ ਹਨ ਅਤੇ ਸਰੀਰ ਦੇ ਚੁੱਕਦੇ ਹਨ ਅਕਸਰ ਉੱਚੀ ਉੱਚੀ ਬਾਹਾਂ ਜਾਂ ਮੋਢੇ ਨਾਲ ਹਿਲਜੁਲ ਨਾਲ ਬੋਲੀਆਂ ਅਤੇ ਛੋਟੇ ਗੀਤ ਉੱਤੇ ਸਭ ਤੋਂ ਮਹੱਤਵਪੂਰਨ ਢੋਲ ਦੀ ਧੁਨ ਉੱਤੇ ਇੱਕ ਸਿਰ ਉੱਤੇ ਇੱਕ ਭਾਰੀ ਬੀਟਰ ਨਾਲ ਦੂਜੇ ਪਾਸੇ ਹਲਕੀ ਸੋਟੀ ਨਾਲ ਢੋਲ ਦੇ ਸਾਊਂਡ ਉੱਪਰ ਸਰੀਰ ਨੂੰ ਹਿਲਜੁਲ ਕਰਾਉਂਦੇ ਹਨ ਝੂਲਦਾ ਤਾਲ ਪਾਤਰ ਜੋ ਆਮ ਭੰਗੜਾ ਸੰਗੀਤ ਵਿਸ਼ੇਸ਼ਤਾ ਰਿਹਾ ਹੈ ਇੱਕ ਊਰਜਾ ਜਵਾਨ ਪੰਜਾਬੀ ਨਾਚ ਭੰਗੜਾ ਇੱਕ ਸੱਭਿਆਚਾਰਕ ਫਰੀਕ ਜਸ਼ਨ ਵੱਲੋਂ ਪੰਜਾਬੀ ਕਿਸਾਨਾਂ ਨਾਲ ਸ਼ੁਰੂ ਹੋਇਆ ਇਹ ਭੰਗੜੇ ਵਿੱਚ ਕਾਫੀ ਜ਼ਿਆਦਾ ਸਟੈਪ ਹਨ ਜੋ ਕਿ ਇੱਕ ਮਿੰਟ ਦੀ ਵੀਡੀਓ ਵਿੱਚ ਬਿਆਨ ਨਹੀਂ ਹੋ ਸਕਦੇ ਪੰਜਾਬੀ ਭੰਗੜੇ ਵਿੱਚ ਕਈ ਰਿਵਾਇਤਾਂ ਜੋ ਪੰਜਾਬ ਦੀਆਂ ਜੜਾਂ ਨਾਲ ਜੁੜੀਆਂ ਹੋਈਆਂ ਹਨ ਜਦੋਂ ਕਿ ਪ੍ਰਸਿੱਧ ਸੰਗੀਤ ਸਮੂਹ ਅਧਾਰਿਤ ਮੁਕਾਬਲਿਆਂ ਅਤੇ ਮੇਲਿਆਂ ਵਿੱਚ ਭੰਗੜੇ ਦੇ ਕਈ ਸਟੈਪ ਅਲੱਗ ਅਲੱਗ ਤਰ੍ਹਾਂ ਵਰਤੇ ਜਾਂਦੇ ਹਨ ਇਹ ਇੱਥੋਂ ਤੱਕ ਕਿ ਭੰਗੜੇ ਵਿੱਚ ਸਕੂਲਾਂ ਅਤੇ ਸਟੂਡੀਓ ਵਿੱਚ ਡਾਂਸ ਪ੍ਰੋਗਰਾਮ ਵੀ ਕੀਤੇ ਜਾਂਦੇ ਹਨ